ਹਾਂਜੀ ਮੈਂ ਆਪਣੀ ਮੂਲ ਭਾਸ਼ਾ ਨਾਲ਼ੋਂ ਵੱਖਰੀਆਂ ਭਾਸ਼ਾਵਾਂ ਤੋਂ ਅਨੁਵਾਦਤ ਕਾਫ਼ੀ ਪੁਸਤਕਾਂ ਪੰਜਾਬੀ ਅੰਦਰ ਪੜ੍ਹੀਆਂ ਹਨ ਜਿੱਦਾਂ ਕਿ ਇੱਕ ਜਿਹੜੀ ਮੈਂ ਹੁਣੇ ਪਿੱਛੇ ਜੇ ਪੜ੍ਹੀ ਸੀ ਉਹ ਸੀ ਖ਼ਲੀਲ ਜਿਬਰਾਨ ਦੀ ਕਿਤਾਬ ਪੈਗੰਬਰ ਜਿਹਦਾ ਕਿ ਅਸਲ ਵਿੱਚ ਅੰਗਰੇਜ਼ੀ ਵਿੱਚ ਨਾਮ ਹੈ ਦਾ ਪ੍ਰੋਫਿਟ ਉਹ ਕਿਤਾਬ ਜਦੋਂ ਅਨੁਵਾਦ ਕੀਤੀ ਗਈ ਤਾਂ ਉਹਦੇ ਕਾਫ਼ੀ ਜਿਹੜੇ ਤੱਥ ਹਨ ਉਹ ਬਦਲ ਗਏ ਪਰ ਜਿਹੜੇ ਜਿਹੜੀ ਮੇਨ ਭਾਵ ਹੈ ਭਾਵ ਅਰਥ ਉਹ ਅਨੁਵਾਦਕ ਨੇ ਕਾਫ਼ੀ ਹੱਦ ਤੱਕ ਉਹੀ ਰੱਖਿਆ ਜੋ ਲੇਖਕ ਦਾ ਭਾਵ ਅਰਥ ਸੀ ਅਨੁਵਾਦ ਵਿੱਚ ਇਹੀ ਇੱਕ ਵੱਡੀ ਜਿਹੜੀ ਮੁਸ਼ਕਿਲ ਹੈ ਚੁਣੌਤੀ ਹੈ ਉਹ ਆਉਂਦੀ ਹੈ ਕਿ ਲੇਖਕ ਦਾ ਭਾਵ ਅਰਥ ਸਮਝਣਾ ਉਹਨੂੰ ਉਹਦੀ ਮੂਲ ਭਾਸ਼ਾ 'ਚੋਂ ਆਪਣੀ ਮੂਲ ਭਾਸ਼ਾ 'ਚ ਅਨੁਵਾਦ ਕਰਨਾ ਉਹਨੂੰ ਬਦਲਣਾ ਇਹ ਬੜਾ ਔਖਾ ਹੋ ਜਾਂਦਾ ਮੈਂ ਅਨੁਵਾਦਕ ਸੰਸਕਰਨ ਬਾਰੇ ਕਾਫ਼ੀ ਵਾਰ ਸੋਚਦੀ ਹਾਂ ਅਤੇ ਪੰਜਾਬੀ ਵਿੱਚੋਂ ਪੜ੍ਹ ਕੇ ਜੇ ਮੈਨੂੰ ਮੂਲ ਭਾਸ਼ਾ ਆਉਂਦੀ ਹੈ ਜਿਹੜੀ ਉਹ ਉਹ ਲਿਖਤ ਦੀ ਅਗਰ ਮੂਲ ਭਾਸ਼ਾ ਮੈਨੂੰ ਆਉਂਦੀ ਹੋਵੇ ਤਾਂ ਮੈਂ ਉਹਨੂੰ ਦੁਬਾੜਾ ਦੁਬਾਰਾ ਉਹ ਮੂਲ ਭਾਸ਼ਾ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ ਅਤੇ ਨਵਾਂ ਇੱਕ ਨਜ਼ਰੀਆ ਜਿਹੜਾ ਉਹ ਮੇਰੇ ਸਾਹਮਣੇ ਆਉਂਦਾ ਪਰ ਇੱਕ ਗੱਲ ਮੈਂ ਹੋਰ ਜਿਹੜੀ ਦੇਖੀ ਉਹ ਇਹ ਹੈ ਕਿ ਕਿਸੇ ਵੀ ਲਿਖਤ ਨੂੰ ਜਦੋਂ ਮੈਂ ਆਪਣੀ ਮੂਲ ਭਾਸ਼ਾ ਪੰਜਾਬੀ ਵਿੱਚ ਪੜ੍ਹਦੀ ਹਾਂ ਉਹ ਮੇਰੇ 'ਤੇ ਜ਼ਿਆਦਾ ਡੂੰਘਾ ਅਸਰ ਕਰਦੀ ਹੈ ਅਤੇ ਜਦੋਂ ਮੈਂ ਕਿਸੇ ਅੰਗਰੇਜ਼ੀ ਲਿਖਤ ਨੂੰ ਵੀ ਪੜ੍ਹਨ ਤੋਂ ਬਾਅਦ ਯਾਦ ਕਰਦੀ ਹਾਂ ਦੁਬਾਰਾ ਸੋਚਦੀ ਹਾਂ ਉਹਦੇ ਬਾਰੇ ਤਾਂ ਉਹਦਾ ਜਿਹੜਾ ਭਾਵ ਅਰਥ ਹੈ ਉਹ ਮੇਰੇ ਖਿਆਲਾਂ ਦੇ ਅੰਦਰ ਪੰਜਾਬੀ ਵਿੱਚ ਆਪਣੇ ਆਪ ਸਹਿਜ ਸੁਭਾਅ ਹੀ ਅਨੁਵਾਦਿਤ ਹੋ ਕੇ ਮੇਰੇ ਖਿਆਲਾਂ ਦੇ ਵਿੱਚ ਬਹਿ ਜਾਂਦਾ ਤਾਂ ਇਸ ਤਰ੍ਹਾਂ ਤਰਜਮਾ ਕਰਨ ਦੀ ਜਿਹੜੀ ਕਲਾ ਹੈ ਭਾਵ ਅਰਥ ਸਮਝਣ ਦੀ ਕਲਾ ਕਿੱਦਾਂ ਵਰਤਣਾ ਹੈ ਸ਼ਬਦ ਉਹੀ ਰੱਖਣੇ ਹਨ ਜਾਂ ਭਾਵ ਰੱਖਣਾ ਹੈ ਇਹ ਸਾਰੀਆਂ ਜਿਹੜੀਆਂ ਚੁਣੌਤੀਆਂ ਹਨ ਇਹ ਔਖੀਆਂ ਵੀ ਹੋ ਜਾਂਦੀਆਂ ਹਨ ਪਰ ਇੱਕ ਸੱਭਿਆਚਾਰ ਅਤੇ ਦੂਜੀ ਸੱਭਿਆਚਾਰ ਦੇ ਵਿੱਚ ਭਾਵਾਂ ਦਾ ਤਰਜਮਾ ਕਰਨਾ ਇੱਕ ਆਪਣੇ ਆਪ ਦੇ ਵਿੱਚ ਬੜਾ ਹੀ ਰੋਚਕਤਾ ਭਰਪੂਰ ਵਿਸ਼ਾ ਵੀ ਹੋ ਨਿਬੜਦਾ ਹੈ ਅਤੇ ਆਪਣੀ ਮੂਲ ਭਾਸ਼ਾ ਦੇ ਵਿੱਚੋਂ ਉਹ ਕਿਤਾਬ ਜਿਹੜੀ ਮੈਂ ਚਾਹੁੰਦੀ ਹਾਂ ਸਾਰੀ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਪੜ੍ਹੇ ਉਹ ਹੈ ਬਾਬਾ ਨੌਧ ਸਿੰਘ ਭਾਈ ਵੀਰ ਸਿੰਘ ਜੀ ਦੀ ਪੁਸਤਕ ਇਹ ਪੁਸਤਕ ਦੇ ਅੰਦਰ ਪੰਜਾਬੀ ਪੇਂਡੂ ਜੀਵਨ ਦਿਖਾਇਆ ਗਿਆ ਅਤੇ ਬੜਾ ਹੀ ਸਹਿਜਤਾ ਵਾਲਾ ਪੇਂਡੂ ਜੀਵਨ ਹੈ ਓਸ ਮੋੜ 'ਤੇ ਜਦੋਂ ਬਸਤੀਵਾਦ ਪੰਜਾਬ ਅੰਦਰ ਆ ਰਿਹਾ ਹੈ ਅਤੇ ਪੰਜਾਬ ਦੀ ਜਿਹੜੀ ਜੀਵਨ ਸ਼ੈਲੀ ਹੈ ਉਹ ਬਦਲ ਰਹੀ ਹੈ ਅਤੇ ਉਹਦੇ ਅੰਦਰ ਕਿੱਦਾਂ ਵੱਖ ਵੱਖ ਜਿਹੜੇ ਨਾਵਲ ਦੇ ਚਰਿੱਤਰ ਹਨ ਉਹ ਉਹਨੂੰ ਕਿੱਦਾਂ ਲੈਂਦੇ ਹਨ ਅਤੇ ਕਿੱਦਾਂ ਬਦਲਦੇ ਹਨ ਅਤੇ ਕਿੱਦਾਂ ਆਖਰਕਾਰ ਆਪਣੇ ਸੱਭਿਆਚਾਰ ਨੂੰ ਦੁਬਾਰਾ ਆਪਣੇ ਸਾਹਮਣੇ ਰੱਖ ਮੁੜ ਵਿਚਾਰਦੇ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ ਉਹ ਮੈਨੂੰ ਬੜਾ ਹੀ ਪ੍ਰਭਾਵਸ਼ਾਲੀ ਨਾਵਲ ਲੱਗਦਾ ਜਿਹੜਾ ਕਿ ਮੈਨੂੰ ਲੱਗਦਾ ਕਿ ਸਾਰਿਆਂ ਬਾਰੇ ਸਾਰਿਆਂ ਵੱਲੋਂ ਇੱਕ ਅੱਧੀ ਵਾਰ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਹੈ